ਮੇਰਾ ਅਚਾਨਕ ਵਜਨ ਵਧਣ ਲੱਗ ਗਿਆ ਸੀ ਕੰਮ ਨਾ ਹੋਣ ਕਰਕੇ ਘਰੇ ਵੇਹਲੇ ਬੈਠੇ ਹੋਣ ਕਰਕੇ ਕਿਸੇ ਖਾਣ ਪੀਣ ਕਰਕੇ ਮੇਰਾ ਵਜਨ ਵਧਣ ਲੱਗ ਗਿਆ ਸੀ ਕਿਸੇ ਨੇ ਮੈਨੂੰ ਯੋਗਾ ਬਾਰੇ ਦੱਸਿਆ ਅਤੇ ਫਿਰ ਮੈਂ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਮੈਂ ਯੋਗਾ ਕਰਦਾ ਗਿਆ ਮੇਰੇ ਸਰੀਰ ਵਿੱਚ ਮੈਨੂੰ ਫਰਕ ਦਿਖਣ ਲੱਗ ਗਿਆ ਅਤੇ ਸਰੀਰ ਮੇਰਾ ਅੱਗੇ ਨਾਲੋਂ ਬਹੁਤ ਹੀ ਚੰਗਾ ਅਤੇ ਵਧੀਆ ਫਿੱਟ ਹੋ ਗਿਆ ਹੈ ਅੱਗੇ ਨਾਲੋਂ ਮੈਂ ਉਹ ਬਹੁਤ ਹੀ ਚੰਗਾ ਮਹਿਸੂਸ ਕਰਨਾ ਹਾਂ ਚੱਲਣ ਫਿਰਨ 'ਚ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਅੱਗੇ ਨਾਲ ਮੇਰੀ ਜੋ ਬੋਡੀ ਹੈ ਫਰੈਸ਼ ਹੋ ਚੁੱਕੀ ਹੈ ਤਰੋ ਤਾਜ਼ਾ ਹੋ ਚੁੱਕੀ ਹੈ ਅੱਗੇ ਨਾਲੋਂ